ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਅਸੀਂ ਹਰਿਆਣੇ ਤੋਂ ਆਏ ਹਾਂ ਤੁਹਾਡੇ ਗੁਆਂਢੀ ਹਾਂਜੀ ਅਸੀਂ ਨਵੇਂ ਨਵੇਂ ਇੱਥੇ ਆਏ ਹਾਂ ਸਾਨੂੰ ਇੰਨਾ ਇੱਥੋਂ ਦਾ ਪਤਾ ਨਹੀਂ ਹੈ ਅਸੀਂ ਤੁਹਾਡੇ ਕੋਲੋਂ ਥੋੜ੍ਹਾ ਜਿਹਾ ਸਿੱਖ ਧਰਮ ਬਾਰੇ ਪੁੱਛਣਾ ਚਾਹੁੰਦੇ ਹਾਂ ਕੀ ਦੱਸ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਹਾਂਜੀ ਹੈਲੋ ਹਾਂਜੀ ਆਵਾਜ਼ ਆ ਰਹੀ ਆ ਤੁਹਾਡੀ ਹਾਂਜੀ ਹਾਂਜੀ ਹਾਂਜੀ

ਹਾਂਜੀ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਸੀਂ ਸਾਨੂੰ ਇਸ ਬਾਰੇ ਦੱਸਿਆ ਜਾਣਕਾਰੀ ਦਿੱਤੀ